ਹਾਂਜੀ ਮੈਂ ਬਹੁਤ ਜਖਮੀ ਪੰਛੀਆਂ ਨੂੰ ਦੀ ਮਲਵਤ ਮਲੱਮ ਪੱਟੀ ਕੀਤੀ ਹੈ ਜਿਸ ਦੇ ਵਿੱਚ ਉਹ ਉੱਡਦੇ ਉੱਡਦੇ ਕਦੇ ਡੋਰਾਂ ਵਿੱਚ ਫਸ ਜਾਂਦੇ ਸੀ ਕਦੇ ਤਾਰਾਂ 'ਤੇ ਲਟਕਦੇ ਹੁੰਦੇ ਸੀ ਅਤੇ ਮੈਂ ਉਸ ਵਿੱਚ ਉਹਨਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕਰਕੇ ਉਹਨਾਂ ਨੂੰ ਮੱਲਮ ਪੱਟੀ ਲਗਾ ਕੇ ਜ ਜ਼ਖਮੀ ਹਾਲਤ ਉਹ ਵਧੀਆ ਤਰੀਕੇ ਨਾਲ ਲਗਾ ਕੇ ਉਹਨਾਂ ਨੂੰ ਸਹੀ ਕਰਕੇ ਉਡਾ ਦਿੱਤਾ ਇਹ ਮੇਰੀ ਸਭ ਤੋਂ ਵੱਡੀ ਯਾਦਗਾਰੀ ਸੀਗੀ ਜਦੋਂ ਮੈਂ ਕਿਤੇ ਜਾ ਰਿਹਾ ਸੀ ਅਤੇ ਮੈਨੂੰ ਇੱਕ ਪੰਛੀ ਨਜ਼ਰ ਆਇਆ ਜਿਹਦੇ ਜਿਹਦੇ ਪਰ ਡੋਰ ਦੇ ਨਾਲ ਕੱਟਿਆ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਉਹਨੂੰ ਮੈਂ ਉਸ ਡੋਰ ਤੋਂ ਮੁਕਤ ਕੀਤਾ ਓਹ ਡੋਰ ਤੋਂ ਨਿਕਾਲੀ ਉਹਦੇ ਪੰਖ ਵਿੱਚੋਂ ਅਤੇ ਮੱਲਮ ਪੱਟੀ ਕੀਤੀ ਜਿਸ ਨਾਲ ਉੱਥੇ ਉਸ ਉੱਪਰ ਟਿਊਪ ਲਗਾਈ ਅਤੇ ਉਸ ਤੋਂ ਬਾਅਦ ਉਹਨੂੰ ਠੀਕ ਕਰਕੇ ਉਡਾ ਦਿੱਤਾ ਅਤੇ ਉਹਦੇ ਦੌਰਾਨ ਇਸ ਤਰ੍ਹਾਂ ਇਹ ਮੇਰੀ ਇੱਕ ਯਾਦਗਾਰੀ ਤਕਨੀਕ ਬਣ ਗਈ ਜਿਹਦੇ ਨਾਲ ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਹ ਆਪਣੀ ਯਾਦਗਾਰੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕੀਤੀ ਮੇਰੀ ਆਪਣੀ ਵਾਰਤਾਲਾਪ ਇਹ ਹੈ ਸਾਂਝੀ ਬਹੁਤ ਯਾਦਗਾਰੀ ਮੈਂ ਬਹੁਤ ਖੁਸ਼ ਹੋਇਆ ਵਾਂ